ਮੈਂ ਆਪਣੇ ਨੇੜਲੇ ਪਿੰਡਾਂ ਅਤੇ ਕਸਬਿਆਂ ਦਾ ਦਿਨ ਵਿੱਚ ਦੋ ਤੋਂ ਤਿੰਨ ਵਾਰ ਦੌਰਾ ਕਰਦਾ ਹਾਂ ਕਿਉਂਕਿ ਪਿੰਡਾਂ ਦੀਆਂ ਹਵਾਵਾਂ ਅਤੇ ਉੱਥੋਂ ਦੇ ਲੋਕ ਬਹੁਤ ਵਧੀਆ ਹੁੰਦੇ ਹਨ ਅਤੇ ਜ਼ਿਆਦਾਤਰ ਮੈਂ ਪਿੰਡਾਂ ਵਿੱਚ ਸਵੇਰ ਨੂੰ ਜਾਨਾ ਹਾਂ ਕਿਉਂਕਿ ਮੈਂ ਉੱਥੇ ਦੌੜ ਵਗੈਰਾ ਅਤੇ ਕੁਸ਼ਤੀ ਆਦਿ ਵੀ ਜ਼ਰੂਰ ਕਰਦਾ ਹਾਂ ਉੱਥੇ ਦੇ ਹੋਰ ਵੀ ਕਈ ਸਾਰੇ ਅਜਿਹੇ ਕੰਮ ਹਨ ਜੋ ਕਿ ਸ਼ਹਿਰੀ ਬੰਦਾ ਪਿੰਡਾਂ ਵਿੱਚ ਹੀ ਕਰ ਸਕਦਾ ਹੈ ਜਿਵੇਂ ਕਿ ਸਵੇਰੇ ਉੱਠ ਕੇ ਦੌੜ ਲਾਣੀ ਅਤੇ ਹੋਰ ਵੀ ਕਈ ਸਾਰੇ ਅਜਿਹੇ ਕੰਮ ਕਰਨੇ ਜਿਹੜੇ ਕਿ ਸਰੀਰ ਵਾਸਤੇ ਵਾਸਤੇ ਵਧੀਆ ਹੋਣ ਜਿਵੇਂ ਕਿ ਯੋਗਾ ਅਤੇ ਐਕਸਸਾਈਜ਼ ਵਗੈਰਾ